ਹਾਂਜੀ ਹਾਂਜੀ ਤੁਸੀਂ ਕੌਣ ਵਧੀਆ ਵਧੀਆ ਤੁਸੀਂ ਕਿਵੇਂ ਹਾਂਜੀ ਅੱਛਾ ਅੱਛਾ ਮੈਮ ਹਾਂ ਹਾਂਜੀ ਮੈਮ ਵਧੀਆ ਹੈ ਇੱਥੇ ਰੈਸਟੋਰੈਂਟ ਕਾਫੀ ਮਤਲਬ ਜਿੱਦਾਂ ਕਿ ਮੈਨੂੰ ਹਾਂਜੀ ਮੈਨੂੰ ਉਹਨੇ ਦੱਸਿਆ ਤਾ ਮੈਨੂੰ ਕਮਲ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਕਿ ਤੁਸੀਂ ਮੈਨੂੰ ਕਾਲ ਕਰੂੰਗੇ ਹਾਂ ਇੱਥੇ ਫੇਮਸ ਹੈਗਾ ਸ਼ਗੁਨ ਢਾਬਾ ਹੈ ਕਾਫੀ ਵਧੀਆ ਮਤਲਬ ਖਾਣਾ ਹੁੰਦਾ ਇੱਥੇ ਵੀ ਰੇਟ ਵੀ ਠੀਕ ਹੀ ਹੁੰਦਾ ਮਤਲਬ ਕਾਫੀ ਮਤਲਬ ਵਧੀਆ ਵਧੀਆ ਮਤਲਬ ਹੁੰਦੇ ਆ ਡਿਸ਼ਿਜ ਜਿਹਦਾ ਮਤਲਬ ਇੱਥੇ ਸ਼ਾਹੀ ਪਨੀਰ ਕੜਾਹੀ ਪਨੀਰ ਕਾਫੀ ਫੇਮਸ ਹੈ ਇੱਥੇ ਦਾ ਸ਼ਗੁਨ ਢਾਬੇ ਦਾ ਹਾਂਜੀ ਅਤੇ ਹਵੇਲੀ ਹੈ ਮੈਮ ਹਵੇਲੀ ਤੁਹਾਨੂੰ ਪੰਜਾਬੀ ਪੂਰਾ ਡਿਸ਼ ਮਿਲੇਗੀ ਜਿੱਦਾਂ ਸਾਗ ਮੱਕੀ ਦੀ ਰੋਟੀ ਦਹੀਂ ਦਾਲ ਇੱਦਾਂ ਦੀ ਸਭ ਕੁਛ ਮਿਲਦਾ ਇੱਥੇ ਹਵੇਲੀ 'ਚ ਹਾਂਜੀ ਹੋਰ ਇੱਕ ਭਲਵਾਨਾਂ ਦਾ ਢਾਬਾ ਇੱਕ ਉੱਥੇ ਵੀ ਕਾਫੀ ਮਤਲਬ ਹੈਲਦੀ ਹੈਲਦੀ ਚੀਜ਼ਾਂ ਮਿਲਦੀਆਂ ਮਤਲਬ ਕਾਫੀ ਵਧੀਆ ਹੈ ਸ਼ਗੁਨ ਢਾਬਾ ਬੈਸਟ ਹੈ ਬੈਸਟ ਨਹੀਂ ਮਤਲਬ ਠੀਕ ਹੈ ਉੱਥੇ ਕਾਫੀ ਸਫਾਈ ਸਫੁਈ ਵਧੀਆ ਉਹਦੇ ਰੇਟ ਵੀ ਠੀਕ ਠੀਕ ਹੈ ਹਾਂਜੀ ਹਵੇਲੀ ਦਾ ਵੀ ਠੀਕ ਹੈ ਨਹੀਂ ਇਹਨਾਂ ਦਾ ਖਾਣਾ ਕਾਫੀ ਵਧੀਆ ਹੁੰਦਾ ਜਿੱਦਾਂ ਹੁਣ ਤੁਸੀਂ ਹਵੇਲੀ ਦਾ ਲਗਾ ਲਓ ਹਵੇਲੀ ਦਾ ਸਾਗ ਵੀ ਜਿੱਦਾਂ ਵੀ ਚੱਲ ਜਾਉ ਜਦੋਂ ਵੀ ਜਾਉਂਗੇ ਨਾ ਮਤਲਬ ਸਾਗ ਸੂਗ ਵਗੈਰਾ ਕਾਫੀ ਹੁੰਦਾ ਇੱਥੇ ਮਤਲਬ ਵਧੀਆ ਹੁੰਦਾ ਜਦੋਂ ਮੱਖਣ ਵਗੈਰਾ ਸਾਗ ਦੇ ਉੱਤੇ ਪਾ ਕੇ ਦਿੰਦੇ ਮੱਕੀ ਦੀ ਰੋਟੀ 'ਤੇ ਮੱਖਣ ਰੱਖ ਕੇ ਦਿੰਦੇ ਹੈ ਮਤਲਬ ਪੂਰੀ ਮਤਲਬ ਕੋਈ ਵੀ ਤੁਸੀਂ ਪਲੇਟ ਲੈ ਲੂੰਗੇ ਨਾ ਮਤਲਬ ਜਿੱਦਾਂ ਪੂਰੀ ਪਲੇਟ ਹੁੰਦੀ ਹੈ ਖਾਣੇ ਦੀ ਉਸ 'ਚ ਦੋ ਸਬਜ਼ੀਆਂ ਹੁੰਦੀਆਂ ਇੱਕ ਦਹੀਂ ਹੁੰਦਾ ਹੈ ਐਦਾਂ ਜਿੱਦਾਂ ਤੰਦੂਰੀ ਰੋਟੀ ਹੁੰਦੀ ਹੈ ਹੈ ਨਾ ਤੰਦੂਰੀ ਰੋਟੀ ਦੇ ਉੱਤੇ ਮੱਖਣ ਮੁੱਖਣ ਐਦਾਂ ਰੱਖ ਕੇ ਵੀ ਦਿੰਦੇ ਆ ਉਹ ਕਾਫੀ ਮਤਲਬ ਮੈਨੂੰ ਨਾ ਉਹਨਾਂ ਦੀ ਸਰਵਿੰਗ ਬਹੁਤ ਵਧੀਆ ਲੱਗਦੀ ਮਤਲਬ ਸਰਵ ਬਹੁਤ ਅੱਛਾ ਕਰਕੇ ਦਿੰਦੇ ਨਾਲ ਸਲਾਦ ਵਗੈਰਾ ਵੀ ਹੁੰਦਾ ਹੈ ਹਾਂਜੀ ਸਲਾਦ ਹਾਂਜੀ ਮੈਨੂੰ ਉਹਨਾਂ ਦੀ ਸਰਵਿੰਗ ਬਹੁਤ ਵਧੀਆ ਹੁੰਦੀ ਇਹ ਨਾ ਰੋਟੀ ਬਹੁਤ ਅੱਛੇ ਤਰੀਕੇ ਨਾਲ ਸਰਵ ਕਰਕੇ ਦਿੰਦੇ ਹੈ ਹਾਂਜੀ ਮੈਮ ਜੇ ਤੁਹਾਡੇ ਕੋਲ ਟਾਈਮ ਨਹੀਂ ਵੀ ਹੈ ਨਾ ਜਦੋਂ ਕਈ ਵਾਰ ਤੁਸੀਂ ਜ ਜੋਬ ਕਰਦੇ ਹੋ ਨਾ ਤੁਸੀਂ ਜਿੱਦਾਂ ਤੁਹਾ ਤੁਸੀਂ ਸ਼ਾਮ ਨੂੰ ਲੇਟ ਆਓ ਤੁਹਾਡੇ ਕੋਲ ਟਾਈਮ ਨਾ ਹੋਵੇ ਅਤੇ ਜਿਹੜਾ ਸ਼ਗੁਨ ਢਾਬਾ ਹੈ ਨਾ ਉਹ ਟੀਫਿਨ ਪੈਕ ਕਰਕੇ ਵੀ ਦਿੰਦੇ ਆ ਹਾਂਜੀ ਤੁਸੀਂ ਹਾਂ ਜੇ ਤੁਸੀਂ ਟੀਫਿਨ ਲ ਹਾਂਜੀ ਡੇਲੀ ਟੀਫਨ ਸਿਸਟਮ ਵੀ ਇਹਨਾਂ ਦਾ ਹੈਗਾ ਇਹ ਟੀਫਿਨ ਵੀ ਉਹ ਕਰਦੇ ਆ ਤੁਸੀਂ ਜਿੱਦਾਂ ਟਿਫਨ ਲਗਵਾਉਣਾ ਹੋਵੇ ਨਾ ਆਪਣਾ ਤੁਸੀਂ ਇਹਨਾਂ ਨੂੰ ਦੱਸ ਦਿਉ ਅਸੀਂ ਸੋਮਵਾਰ ਨੂੰ ਆਪਣੇ ਟੀਫਿਨ ਦੇ ਵਿੱਚ ਕਿਆ ਖਾਣਾ ਮੰਗਲਵਾਰ ਨੂੰ ਕਿਆ ਖਾਣਾ ਬੁੱਧਵਾਰ ਨੂੰ ਕਿਆ ਖਾਣਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੁਸੀਂ ਇਹਨਾਂ ਦਿਨਾਂ ਕਿਆ ਕਿਆ ਖਾਣਾ ਹੈ ਉਸ ਹਿਸਾਬ ਨਾਲ ਤੁਹਾਡਾ ਇਹਨਾਂ ਨੇ ਬਣਾ ਲੈਣਾ ਹੈ ਅਤੇ ਉਸ ਹਿਸਾਬ ਨਾਲ ਤੁਹਾਨੂੰ ਖਾਣਾ ਦੇਣਾ ਇਹਨਾਂ ਨੇ ਪ੍ਰੋਪਰ ਇਹਨਾਂ ਦਾ ਨਾ ਇੱਕ ਸ਼ਡਿਊਲ ਹੁੰਦਾ ਹੈ ਉਹਦੇ ਹਿਸਾਬ ਨਾਲ ਇਹ ਟੀਫਨ ਪੈਕ ਕਰਦੇ ਹਾਂਜੀ ਮੈਮ ਬਸ ਇਹੀ ਹੈ ਇੱਥੇ ਤਾਂ ਹਾਂਜੀ ਜੇ ਪੁੱਛਣਾ ਹੋਇਆ ਪੁੱਛ ਲਿਓ ਬਾਅਦ 'ਚ ਕੌਲ ਕਰਕੇ ਕੋਈ ਨਹੀਂ ਜਦ ਮਰਜ਼ੀ ਠੀਕ ਹੈ ਮੈਮ ਓਕੇ ਮੈਮ